ਕਿਸਾਨ ਜਿਹੜੇ ਹੈਗੇ ਹੈ ਉਹ ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਮਿੰਗ ਦਾ ਜਿਹੜਾ ਕਾਰੋਬਾਰ ਹੈਗਾ ਉਹ ਬੜੇ ਹੀ ਅਸਾਨ ਤਰੀਕੇ ਨਾਲ ਕਰ ਸਕਦੇ ਹੈਗੇ ਹੈ ਇਸ ਵਾਸਤੇ ਕਿਸਾਨ ਨੂੰ ਜਿਹੜੀ ਹੈਗੀ ਹੈਗੀ ਇਹ ਧੰਦਾ ਸਟਾਰਟ ਕਰਨ ਵਾਸਤੇ ਕਿਸਾਨ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਟਰੇਨਿੰਗ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਿਸਾਨ ਜਿਹੜਾ ਹੈਗਾ ਗਾ ਆਪਣੇ ਘਰ ਦੇ ਵਿੱਚ ਮੱਝਾਂ ਜਿਹੜਾ ਹੈਗਾ ਗਾ ਉਹ ਪਾਲਦਾ ਹੀ ਹੈਗਾ ਗਾ ਜੇ ਉਹ ਹੀ ਮੱਝਾਂ ਉਹ ਉਸ ਤਰ੍ਹਾਂ ਪਸ਼ੂ ਜਿਹੜੇ ਹੈਗੇ ਹੈ ਉਹਦੇ ਵਿੱਚ ਉਹ ਵਾਧਾ ਕਰ ਲਵੇ ਉਹਨਾਂ ਨੂੰ ਕਿਸ ਤਰ੍ਹਾਂ ਉਹਨੇ ਫੀਡ ਦੇਣੀ ਹੈਗੀ ਹੈਗੀ ਉਹਨੂੰ ਉਹ ਸਾਰੀ ਕਿਸਾਨ ਨੂੰ ਕਿਉਂਕਿ ਉਸਦੇ ਧੰਦੇ ਦੇ ਨਾਲ ਹੁੰਦਾ ਮਿਲਦਾ ਜੁਲਦਾ ਕੰਮ ਹੈਗਾ ਉਹਨੂੰ ਪਤਾ ਹੁੰਦਾ ਕਿਸ ਤਰ੍ਹਾਂ ਦਾ ਉਹਨੂੰ ਖ ਖੇਤਾਂ ਦੇ ਵਿੱਚ ਉਹਨੇ ਕਿਸਾਨ ਨੇ ਵੀ ਫੀਡ ਦੇਣੀ ਹੈਗੀ ਹੈਗੀ ਉਹਨੂੰ ਕ ਕਾ ਉਹ ਕਰ ਸਕਦਾ ਹੈਗਾ ਕਿਸਾ ਡੇਅਰੀ ਫਾਰਮ ਤੋਂ ਜਿਹੜਾ ਹੈਗਾ ਕਿਸਾਨ ਜਿਹੜਾ ਹੈਗਾ ਗਾ ਪਸ਼ੂਆਂ ਤੋਂ ਦੁੱਧ ਲੈ ਸਕਦਾ ਦੁੱਧ ਲੈ ਕੇ ਉਸਦੀ ਸ਼ਹਿਰਾਂ ਤੀਕਰ ਸਪਲਾਈ ਕਰ ਸਕਦਾ ਹੈਗਾ ਜਿਸਦੇ ਨਾਲ ਸ਼ਹਿਰਾਂ ਵਾਲਿਆਂ ਨੂੰ ਵੀ ਜਿਹੜਾ ਹੈਗਾ ਗਾ ਸੋਖਾ ਹੋਜੂਗਾ ਦੁੱਧ ਲੈਣਾ ਉਹ ਇਜਲੀ ਜਿਹੜਾ ਹੈਗਾ ਗਾ ਆਪਣਾ ਜਿਹੜਾ ਹੈਗਾ ਗਾ ਕੰਮ ਕਰ ਕਰ ਸਕਦੇ ਹਨ ਅਤੇ ਜਿਹੜਾ ਕਿਸਾਨ ਹੈਗਾ ਇਸਦੇ ਵਿੱਚ ਜਿਹੜੇ ਹੈਗੇ ਛੋਟੇ ਪਸ਼ੂ ਹੋਰ ਤਿਆਰ ਕਰਕੇ ਅਤੇ ਉਹਨਾਂ ਨੂੰ ਅੱਗੇ ਵੇਚ ਕੇ ਆਪਣਾ ਜਿਹੜਾ ਹੈਗਾ ਗਾ ਕਿਸਾਨ ਜਿਹੜਾ ਹੈਗਾ ਗਾ ਮੁਨਾਫ਼ਾ ਕਰ ਸਕਦਾ ਗਾ ਅਤੇ ਇਹ ਜਿਹੜਾ ਕਾਰੋਬਾਰ ਹੈਗਾ ਗਾ ਕਿਸਾਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਰਹੂਗਾ ਅਤੇ ਉਹ ਜਿਹੜਾ ਹੈਗਾ ਇਸਦੇ ਨਾਲ ਪੋਲਟਰੀ ਫਾਰਮ ਵੀ ਜਿਹੜਾ ਹੈਗਾ ਗਾ ਉਹ ਕਰ ਸਕਦਾ ਹੈਗਾ ਗਾ ਜਿਸ ਦੇ ਵਿੱਚ ਉਹ ਚੂਚਿਆਂ ਚੂਚੇ ਤਿਆਰ ਕਰ ਸਕਦਾ ਮੁਰਗਿਆਂ ਤੋਂ ਉਹ ਜਿਹੜਾ ਹੈਗਾ ਗਾ ਵੱਡੇ ਵੱਡੇ ਰੈਸਟੋਰੈਂਟਾਂ ਨੂੰ ਪੈਲਸਾਂ ਦੇ ਵਿੱਚ ਜਿਹੜਾ ਹੈਗਾ ਉਹ ਹੈਗਾ ਮੀਟ ਦੀ ਸਪਲਾਈ ਕਰ ਸਕਦਾ ਉਹ ਆਂਡੇ ਦੇ ਸਕਦਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਗਾ ਉਹਦੇ ਲਈ ਜਿਹੜਾ ਪੋਲਟਰੀ ਫਾਰਮ ਹੈਗਾ ਜਿਹੜਾ ਉਹ ਵੀ ਵਧੀਆ ਸਹਾਇਕ ਰਹੂਗਾ ਦੋ ਕੰਮ ਜਿਹੜੇ ਹੈਗੇ ਇਸ ਤਰ੍ਹਾਂ ਜਿਹੜਾ ਕਿਸਾਨ ਹੈਗਾ ਗਾ ਉਹਦੇ ਸਹਾਇਕ ਧੰਦੇ ਵੱਧਦੇ ਹੈਗੇ ਪੋਲਟਰੀ ਫਾਰਮ ਅਤੇ ਡੇਅਰੀ ਫਾਰਮ